ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ ਮੈਂ ਜਿੱਥੇ ਵੀ ਜਾਵਾਂ ਮੈਂ ਇੱਕ ਅੱਧੀ ਬੁੱਕ ਜ਼ਰੂਰ ਖਰੀਦ ਕੇ ਲੈ ਕੇ ਆਉਂਦੀ ਹਾਂ ਚਾਹੇ ਘੁੰਮਣ ਜਾਵਾਂ ਚਾਹੇ ਕਿਤੇ ਊਂ ਵੀ ਜਾਵਾਂ ਤਾਂ ਇੱਕ ਅੱਧੀ ਬੁੱਕ ਮੈਂ ਜ਼ਰੂਰ ਲੈ ਕੇ ਆਉਂਦੀ ਹਾਂ ਉੱਥੋਂ ਤਾਂ ਵੈਸੇ ਤਾਂ ਮੈਂ ਇੱਕ ਵਰਕਿੰਗ ਵੂਮੈਨ ਹਾਂ ਬਟ ਮੈਂ ਅਕਸਰ ਸੈਚਰਡੇ ਸੰਡੇ ਆਪਣਾ ਇੱਕ ਇੱਕ ਘੰਟਾ ਫਿਕਸ ਹੀ ਰੱਖਦੀ ਹਾਂ ਮੈਂ ਜ਼ਰੂਰ ਪੜ੍ਹਦੀ ਹਾਂ ਤਾਂ ਮੈਨੂੰ ਡੇਲੀ ਵਾਲੀ ਨਿਊਜ਼ ਪੇਪਰ ਜਿਵੇਂ ਉਹਨਾਂ ਦਾ ਨਾਮ ਅਜੀਤ ਜ਼ਰੂਰ ਪੜ੍ਹਦੀ ਹਾਂ ਉਹਨਾਂ ਨੂੰ ਮੈਂ ਡੇਲੀ ਬੇਸਿਸ 'ਤੇ ਹੀ ਪੜ੍ਹਦੀ ਹਾਂ ਅਤੇ ਇੱਕ ਮੈਂ ਹੁਣ ਬੁੱਕ ਪੜ੍ਹ ਰਹੀ ਹਾਂ ਰਾਣੀ ਤੱਤ ਤਾਂ ਮੈਂ ਟੀਚਾ ਬਣਾ ਲੈਂਦੀ ਏ ਕਿ ਮੈਂ ਇਸ ਬੁੱਕ ਨੂੰ ਇੰਨੇ ਮਹੀਨੇ ਵਿੱਚ ਖਤਮ ਕਰਨਾ ਹੀ ਕਰਨਾ ਤਾਂ ਮੈਂ ਉਹਨੂੰ ਜਿਵੇਂ ਡੇਲੀ ਕੁਛ ਨਹੀਂ ਵੀ ਟਾਈਮ ਮਿਲ ਰਿਹਾ ਤਾਂ ਜਿਵੇਂ ਸ਼ਨੀਵਾਰ ਐਤਵਾਰ ਮੈਂ ਇੱਕ ਇੱਕ ਘੰਟਾ ਜ਼ਰੂਰ ਉਸਦੇ ਉੱਪਰ ਧਿਆਨ ਦਿੰਦੀ ਹਾਂ ਮੈਨੂੰ ਇਸ ਤੋਂ ਇਲਾਵਾ ਜਿਵੇਂ ਕਿ ਹੋਰ ਬੁੱਕਸ ਜਿਵੇਂ ਡਿਕਸ਼ਨਰੀ ਦੇ ਰਿਲੇਟਡ ਉਹ ਵੀ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ ਮੈਂ ਨਵੀਆਂ ਨਵੀਆਂ ਚੀਜ਼ਾਂ ਉਹਨਾਂ ਤੋਂ ਸਿੱਖਣ ਨੂੰ ਮਿਲਦੀਆਂ ਹਨ ਜਦੋਂ ਮੈਂ ਅਖਬਾਰ ਪੜ੍ਹਦੀ ਹਾਂ ਕੋਈ ਨਵੀਂ ਨਿਊਜ਼ ਮਿਲਦੀ ਹੈ ਮੈਂ ਉਹਦੇ ਬਾਰੇ ਸਰਚ ਕਰਦੀ ਹਾਂ ਮੈਨੂੰ ਬਹੁਤ ਅੱਛਾ ਲੱਗਦਾ ਉਹਨਾਂ ਬਾਰੇ ਸਰਚ ਕਰਨਾ ਅਤੇ ਮੇਰਾ ਗਿਆਨ ਵੀ ਵੱਧਦਾ ਉਸ ਚੀਜ਼ ਨਾਲ